ਭੰਗੜਾ ਪੰਜਾਬੀਆਂ ਦਾ ਪ੍ਰਮੁੱਖ ਲੋਕ ਨਾਚ ਹੈ ਭੰਗੜੇ ਦੁਆਰਾ ਪੰਜਾਬੀ ਆਪਣੇ ਮਨ ਦੀਆਂ ਰੀਝਾਂ ਅਤੇ ਚਾਵਾਂ ਨੂੰ ਦੂਜਿਆਂ ਸਾਹਮਣੇ ਪ੍ਰਗਟ ਕਰਦੇ ਨੇ ਉਹ ਆਪਣੀਆਂ ਖੁਸ਼ੀਆਂ ਨੂੰ ਜਾਹਰ ਕਰਨ ਦੇ ਲਈ ਭੰਗੜੇ ਦੇ ਰੂਪ ਵਿੱਚ ਉਹਨਾਂ ਦੇ ਸਾਹਮਣੇ ਆਉਂਦੇ ਹਨ ਪੰਜਾਬ ਦੇ ਵਿੱਚ ਕੋਈ ਵੀ ਖੁਸ਼ੀ ਦਾ ਤਿਉਹਾਰ ਹੋਵੇ ਅਤੇ ਭੰਗੜਾ ਨਾ ਪਵੇ ਇਸ ਤਰ੍ਹਾਂ ਦਾ ਸਮਾਂ ਕਦੇ ਨਹੀਂ ਆਉਂਦਾ ਕੋਈ ਵੀ ਕਲਚਰਰ ਪ੍ਰੋਗਰਾਮ ਹੋਵੇ ਭੰਗੜਾ ਉਸ ਦੀ ਜਾਨ ਹੁੰਦਾ ਹੈ ਭੰਗੜੇ ਤੋਂ ਬਿਨਾਂ ਕੋਈ ਵੀ ਪ੍ਰੋਗਰਾਮ ਅਧੂਰਾ ਮੰਨਿਆ ਜਾਂਦਾ ਹੈ ਭੰਗੜਾ ਪੰਜਾਬੀਆਂ ਦੀ ਜਿੰਦ ਜਾਨ ਹੈ ਅੱਜ ਦਾ ਯੁੱਗ ਆਧੁਨਿਕਤਾ ਦਾ ਯੁੱਗ ਹੈ ਇਸ ਦੇ ਨਾਲ ਬੰਦੇ ਦੀਆਂ ਟੈਨਸ਼ਨਾਂ ਦੇ ਵਿੱਚ ਵੀ ਬਹੁਤ ਜ਼ਿਆਦਾ ਵਾਧਾ ਹੋਇਆ ਹੈ ਇਸ ਕਰਕੇ ਹਰ ਇਨਸਾਨ ਆਪਣੇ ਤਣਾਅ ਨੂੰ ਦੂਰ ਕਰਨਾ ਚਾਹੁੰਦਾ ਹੈ ਆਪਣੇ ਤਣਾਅ ਤੋਂ ਮੁਕਤ ਹੋਣ ਦੇ ਲਈ ਉਹ ਸੰਗੀਤ ਜਾਂ ਨਾਚ ਦਾ ਸਹਾਰਾ ਲੈਂਦਾ ਹੈ ਅਤੇ ਭੰਗੜਾ ਉਹਨਾਂ ਦੇ ਲਈ ਜਿੰਦ ਜਾਨ ਦਾ ਕੰਮ ਕਰਦਾ ਹੈ ਭੰਗੜੇ ਨਾਲ ਉਹ ਆਪਣੇ ਸਰੀਰ ਦੀਆਂ ਸਾਰੀਆਂ ਕਸਰਤਾਂ ਨੂੰ ਵੀ ਪੂਰੀਆਂ ਕਰਦੇ ਨੇ ਐਰੋਵਿਕਸ ਪ੍ਰਣਾਲੀ ਵੀ ਇੱਕ ਇਸ ਤਰ੍ਹਾਂ ਦੀ ਪ੍ਰਣਾਲੀ ਹੈ ਜਿਸ ਨੂੰ ਅਸੀਂ ਸੰਗੀਤ ਦੇ ਉੱਤੇ ਆਧਾਰਿਤ ਕਸਰਤ ਕਹਿੰਦੇ ਹਾਂ ਹਰ ਨੌਜਵਾਨ ਆਪਣੇ ਤਣਾਅ ਨੂੰ ਮੁਕਤ ਕਰਨ ਦੇ ਲਈ ਇਸ ਵੱਲ ਵੱਧ ਰਿਹਾ ਹੈ ਉਹ ਡਾਂਸ ਜਾਂ ਨਾਚ ਦੁਆਰਾ ਐਰੋਵਿਕਸ ਪ੍ਰਣਾਲੀ ਨੂੰ ਅਪਣਾ ਕੇ ਆਪਣੇ ਤਣਾਅ ਨੂੰ ਦੂਰ ਕਰਦਾ ਹੈ ਅਤੇ ਭੰਗੜਾ ਇਸ ਦੇ ਰੂਪ ਦੇ ਵਿੱਚ ਬਹੁਤ ਹੀ ਜ਼ਿਆਦਾ ਪ੍ਰਸਿੱਧ ਹੋ ਰਿਹਾ ਹੈ ਕਿਉਂਕਿ ਪੰਜਾਬੀਆਂ ਦੇ ਪ੍ਰਮੁੱਖ ਨਾਚ ਜਿਹੜੇ ਨੇ ਉਹ ਦੇਸ਼ ਵਿਦੇਸ਼ ਦੇ ਵਿੱਚ ਧੂਮ ਪਾ ਰਹੇ ਹਨ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਭੰਗੜਾ ਗਿੱਧਾ ਅਤੇ ਪੰਜਾਬੀ ਸੰਗੀਤ ਨੂੰ ਬਹੁਤ ਪਸੰਦ ਕੀਤਾ ਜਾਂਦਾ ਹੈ ਅਤੇ ਹਰ ਨੌਜਵਾਨ ਭੰਗੜੇ ਦੇ ਨਾਲ ਨਾਲ ਪੰਜਾਬੀ ਸੰਗੀਤ ਨੂੰ ਸੁਣਨਾ ਬਹੁਤ ਪਸੰਦ ਕਰਦਾ ਹੈ ਇਸ ਕਰਕੇ ਇਹ ਕਿਹਾ ਜਾ ਸਕਦਾ ਹੈ ਕਿ ਭੰਗੜਾ ਐਰੋਵਿਕਸ ਭਵਿੱਖ ਦੇ ਰੂਪ ਦੇ ਵਿੱਚ ਬਹੁਤ ਜ਼ਿਆਦਾ ਪ੍ਰਸਿੱਧ ਹੈ ਇਹ ਕਸਰਤ ਦਾ ਕੰਮ ਵੀ ਕਰਦਾ ਹੈ ਅਤੇ ਇਸ ਦੇ ਨਾਲ ਹਰ ਇਨਸਾਨ ਮਾਨਸਿਕ ਤੌਰ 'ਤੇ ਸੰਤੁਸ਼ਟੀ ਮਹਿਸੂਸ ਕਰਦਾ ਹੈ ਅਤੇ ਆਪਣੇ ਤਣਾਅ ਨੂੰ ਦੂਰ ਕਰ ਸਕਦਾ ਹੈ